ਹਾਂ ਨਮਸਕਾਰ ਸਰ ਸਰ ਮੈਂ ਦੀਪ ਦੀਪਕ ਸਮੈਲ ਗੱਲ ਕਰ ਰਿਹਾ ਹਾਂ ਆ ਸਰ ਮੈਂ ਜਿਹੜੀ ਆਪਣੀ ਸਿੰਮ ਹੈ ਉਹ ਸਰ ਮੈਂ ਥਰੀ ਜੀ ਤੋਂ ਫੋਰ ਜੀ ਜਿਹੜੀ ਆ ਉਹ ਮੈਂ ਕਨਵਰਟ ਕਰਵਾਉਣੀ ਆ ਜੀ ਸਰ ਫਿਲਹਾਲ ਮੈਂ ਜੀਓ ਦੀ ਸਿੰਮ ਯੂਜ਼ ਕਰ ਰਿਹਾ ਅਤੇ ਜੀਓ ਦੇ ਨੈਟਵਰਕ ਤਾਂ ਠੀਕ ਆ ਲੇਕਿਨ ਮੈਨੂੰ ਥਰੀ ਜੀ ਤੋਂ ਫੋਰ ਜੀ ਚਾਹੀਦੀ ਹੈ ਸਰ ਜੀ ਜੀ ਸਰ ਜਦੋਂ ਠੀਕ ਹੈ ਸਰ ਮੈਨੂੰ ਇੱਕ ਗੱਲ ਦੱਸਣਾ ਕਿ ਜੇ ਮੈਂ ਥਰੀ ਜੀ ਤੋਂ ਫੋਰ ਜੀ ਆਪਣੀ ਸਿੰਮ ਕਨਵਰਟ ਕਰਾਉਨਾ ਤਾਂ ਮੇਰਾ ਫੋਨ ਨੰਬਰ ਉਹੀ ਰਹੇਗਾ ਜੀ ਠੀਕ ਆ ਮਤਲਬ ਇਹ 'ਚ ਕੋਈ ਦਿੱਕਤ ਨਹੀਂ ਆਏਗੀ ਕਿ ਫੋਨ ਨੰਬਰ ਚੇਂਜ ਹੋਣਾ ਜਾਂ ਕਿਸ ਤਰ੍ਹਾਂ ਸਰ ਇਹਦਾ ਕਿੰਨੇ ਦਾ ਪਲੈਨ ਆ ਅਤੇ ਕਿੰਨੇ ਦਿਨ ਦੀ ਵੈਲਿਡਿਟੀ ਹੋਏਗੀ ਜੀ

ਸਰ ਕਿੰਨੇ ਦਿਨ ਦੀ ਵੈਲਿਡਿਟੀ ਆ ਅਠਾਈ ਦਿਨ ਦੀ

ਅਤੇ ਸਰ ਤੁਹਾਡੇ ਜਦੋਂ ਅਸੀਂ ਥਰੀ ਜੀ ਤੋਂ ਫੋਰ ਜੀ 'ਤੇ ਜਾਂਦੇ ਹਾਂ ਤਾਂ ਤੁਹਾਡੇ ਨੈਟਵਰਕ ਇਸ਼ੂ ਤਾਂ ਨਹੀਂ ਆਉਂਦੇ ਜਿੱਦਾਂ ਪਿੰਡਾਂ ਦੇ ਵਿੱਚ ਦੂਰ ਦੂਰ ਆਪਾਂ ਜਦੋਂ ਜਾਂਦੇ ਹਾਂ ਫਿਰ ਕੋਈ ਡਿਸਕਾਊਂਟ ਵਗੈਰਾ ਜਾਂ ਕੋਈ ਆਫਰ ਵਗੈਰਾ ਤੁਸੀਂ ਦੱਸ ਸਕਦੇ ਹੋ ਵੀ ਜੇ ਅਸੀਂ ਲ ਕਰਵਾਉਂਦੇ ਆ ਤਾਂ ਕੀ ਸਾਨੂੰ ਕੀ ਬੈਨੀਫਿਟ ਹੋਏਗਾ ਜੀ ਸਰ ਇਸ ਤਰ੍ਹਾਂ ਹੁੰਦਾ ਵੀ ਜੇ ਮੈਂ ਦੋ ਤੋਂ ਦੋ ਜਾਂ ਦੋ ਤੋਂ ਵੱਧ ਸਿੰਮਾਂ ਐਂ ਕਰਵਾਉਂਦਾ ਤਾਂ ਮੈਨੂੰ ਕੋਈ ਬੈਨੀਫ ਬੈਨੀਫਿਟ ਕੋਈ ਹੋਰ ਇਸ ਤੋਂ ਇਲਾਵਾ ਮਿਲੇਗਾ ਠੀਕ ਆ ਸਰ ਮੈਂ ਤੁਹਾਡੀ ਦੁਕਾਨ 'ਤੇ ਵਿਜਿਟ ਕਰਾਂਗਾ ਅਤੇ ਫਿਰ ਮੈਂ ਆਣ ਕੇ ਜਿੱਦਾਂ ਵੀ ਮੈਨੂੰ ਸਹੀ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਜੀ ਓਕੇ ਸਰ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਓਕੇ